ਸਤਿ ਸ਼੍ਰੀ ਅਕਾਲ ਜੀ ਮੈਂ ਥੋੜ੍ਹੇ ਦਿਨ ਪਹਿਲਾਂ ਤੁਹਾਡੀ ਕੰਪਨੀ ਤੋਂ ਇੱਕ ਸਮਾਰਟ ਵੌਚ ਔਡਰ ਕੀਤੀ ਸੀਗੀ ਅਤੇ ਮੈਨੂੰ ਬੜਾ ਖਿੱਝ ਨਾਲ ਕਹਿਣਾ ਪੈ ਰਿਹਾ ਵੀ ਜਿਹੜੀ ਤੁਹਾਡੀ ਸਮਾਰਟ ਵੌਚ ਹੈ ਜੀ ਇੱਕ ਤਾਂ ਡਿਲੀਵਰੀ ਮੈਨੂੰ ਕਾਫੀ ਜ਼ਿਆਦਾ ਲੇਟ ਮਿਲੀ ਹੈ ਜਿਸ ਤੋਂ ਮੈਂ ਬੈਅ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੁਹਾਡੀ ਜਿਹੜੀ ਕੰਪਨੀ ਦੀ ਹੁਣ ਵੌਚ ਮੈਨੂੰ ਅ ਅੱਜ ਮਿਲੀ ਹੈ ਜੋ ਕਿ ਕਾਫੀ ਲੇਟ ਹੈ ਉਹਦੀ ਜਿਹੜੀ ਵੌਚ ਕੁਆਲਿਟੀ ਆ ਮੈਂ ਕੋ ਪੈਕਿੰਗ ਹੈਗੀ ਹੈ ਜੋ ਉਹ ਪੈਕਿੰਗ ਬਿਲਕੁਲ ਸਹੀ ਨਹੀਂ ਕੀਤੀ ਹੋਈ ਪੈਕਿੰਗ ਡੈਮੇਜ ਪੈਕ ਮੈਨੂੰ ਮਿਲੀ ਹੈ ਸਮਾਰਟ ਵੌਚ ਜੋ ਤੁਹਾਡੀ ਮੈਂ ਦੇਖੀ ਹੈ ਇਹਦੇ ਵਿੱਚ ਕੁਆਲਿਟੀ ਹੈਗੀ ਜਿਹੜੀ ਓਹ ਬਹੁਤ ਹੀ ਘਟੀਆ ਕੁਆਲਿਟੀ ਦਾ ਮਟੀਰੀਅਲ ਯੂਜ਼ ਕੀਤਾ ਹੋਇਆ ਕੰਪਨੀ ਜੋ ਹੈ ਕੰਪਨੀ ਜਿਹੜੀ ਤੁਹਾਡੀ ਵੌਰਕ ਵੌਚ ਹੈਗੀ ਹੈ ਪ੍ਰੋਪਰ ਵੇਅ ਨਾਲ ਔਨ ਵੀ ਨਹੀਂ ਹੋ ਰਹੀ ਨਾ ਇਹ ਚਾਰਜਿੰਗ ਹੋ ਰਹੀ ਹੈ ਇਸ ਕੰਪਨੀ ਦੇ ਜਿਹੜੇ ਸੈਂਸਰ ਹੈਗੇ ਨਾ ਪਰੋਪਰ ਤਰੀਕੇ ਨਾਲ ਕੰਮ ਕਰ ਰਹੇ ਹੈ ਕੰਪਨੀ ਦੀ ਜਿਹੜੀ ਜੋ ਤੁਹਾਡੇ ਪਲਾਸਟਿਕ ਕੁਆਲਿਟੀ ਆ ਜੋ ਵੀ ਤੁਹਡਾ ਬੈਟਰੀ ਬੈਕਅੱਪ ਹੈਗਾ ਓਹ ਬਿਲਕੁਲ ਤਸੱਲੀ ਅਬ ਤਸ ਤਸੱਲੀਬਖਸ਼ ਨਹੀਂ ਹੈ ਨਾ ਇਸ ਕ ਵੌਚ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਅਤੇ ਮੈਂ ਅ ਨਹੀਂ ਚਾਹੁੰਦਾ ਵੀ ਕੋਈ ਹੋਰ ਇਸ ਵੌਚ ਨੂੰ ਖਰੀਦੇ ਇਸ ਲਈ ਮੈਂ

ਤੁਹਾਡੀ ਜਿਹੜੀ ਵੌਚ ਹੈਗੀ ਵਾਪਸ ਕਰਨਾ ਚਾਹੁੰਦਾ ਧੰਨਵਾਦ ਜੀ